ਮੇਰੀ ਮਨ ਪਸੰਦ ਬਾਈਕ ਦੇ ਵਿੱਚ ਹੋਂਡਾ ਗਲੈਮਰ ਬਜਾਜ ਪਲੈਟਨਾ ਹੋਂਡਾ ਸੀ ਡੀ ਡੋਨ ਅਤੇ ਬੁਲੇਟ ਹਨ ਬੁਲੇਟ ਮੇਰੀ ਡਰੀਮ ਬਾਈਕ ਵੀ ਹੈ ਇਹਨਾਂ ਬਾਈਕਾਂ ਦੇ ਉੱਤੇ ਮੈਂ ਸਦਾ ਆਰਾਮਦਾਇਕ ਮਹਿਸੂਸ ਕਰਦਾ ਹਾਂ ਇਹਨਾਂ ਦੇ ਵਿੱਚੋਂ ਬੁਲਟ ਬਾਈਕ ਹੈ ਜੋ ਉਹ ਸਭ ਤੋਂ ਜ਼ਿਆਦਾ ਯਾਤਰਾ ਦੇ ਲਈ ਆਰਾਮਦਾਇਕ ਹੈ ਕਿਉਂ ਕਰਕੇ ਉਸ ਨੂੰ ਚਲਾਉਂਦੇ ਹੋਏ ਤੁਸੀਂ ਲਗਾਤਾਰ ਥੱਕਦੇ ਨਹੀਂ ਹੋ